ਮੈਨੂੰ ਕੋਟੀਆਂ ਸਵੈਟਰਾਂ ਅਤੇ ਸਲਾਈ ਕਢਾਈ ਦਾ ਮੈਨੂੰ ਸ਼ੁਰੂ ਤੋਂ ਹੀ ਬਹੁਤ ਸ਼ੌਂਕ ਹੈ ਮੈਂ ਸੂਟ ਵੀ ਸੀਨੀ ਹਾਂ ਕਢਾਈ ਵੀ ਕਰਦੀ ਹਾਂ ਸਲਾਈ ਦਾ ਕੰਮ ਵੀ ਕਰਦੀ ਹਾਂ ਅਤੇ ਕਰੋਸ਼ੀਏ ਦਾ ਕੰਮ ਵੀ ਕਰਦੀ ਹਾਂ ਅਤੇ ਇੱਕ ਤਾਂ ਹੁਣੇ ਹੁਣੇ ਮੈਂ ਪਿਛਲੇ ਮਹੀਨੇ ਰਿਸ਼ਤੇਦਾਰਾਂ ਗੁਆਂਢੀਆਂ ਨੂੰ ਇੱਕ ਜਾਕੇਟ ਬਣਾ ਕੇ ਦਿੱਤੀ ਜੇਬਾਂ ਲਗਾ ਕੇ ਵਧੀਆ ਡਿਜ਼ਾਈਨ ਪਾ ਕੇ ਜੋ ਕਿ ਮੈਂ ਉਸ ਨੂੰ ਗਿਫ਼ਟ ਕੀਤੀ ਹੈ ਅਤੇ ਜੋ ਜਾ ਕੇ ਉਸ ਨੇ ਮੈਨੂੰ ਫ਼ੋਨ ਕੀਤਾ ਅਤੇ ਕਹਿੰਦੇ ਆ ਕਿ ਜਾਕੇਟ ਬਹੁਤ ਗਰਮ ਹੈ ਵਧੀਆ ਏ ਸਫ਼ਾਈ ਦਾਰ ਹੈ ਅਤੇ ਬਹੁਤ ਵਧੀਆ ਲੱਗਿਆ ਮੈਨੂੰ ਅਤੇ ਮੈਂ ਲ ਗੁਆਂਢੀਆਂ ਨੂੰ ਵੀ ਸਿਖਾਉਂਦੀ ਐਂ ਜੇ ਕੋਈ ਸਿੱਖਦਾ ਮੈਂ ਉਨ੍ਹਾਂ ਨੂੰ ਵੀ ਸਿਖਾਂਨੀ ਹਾਂ ਜੇ ਕਿਸੇ ਨੇ ਕੁੰਡੇ ਪਵਾਣੇ ਹੋਣ ਮੈਂ ਕੁੰਡੇ ਪਾ ਕੇ ਦੇ ਦਿੰਦੀ ਹਾਂ ਜੇ ਕਿਸੇ ਨੇ ਮੁੱਲ ਖਰੀਦਣੀ ਕੋਈ ਜਾਕੇਟ ਜਾਂ ਕੋਈ ਕੋਟੀ ਮੈਂ ਕਿਸੇ ਨੂੰ ਮੁੱਲ ਵੀ ਵੇਚ ਦਿੰਦੀ ਹਾਂ ਅਤੇ ਵਧੀਆ ਵਧੀਆ ਡਿਜ਼ਾਈਨ ਪਾ ਕੇ ਵੇਚਦੀ ਹਾਂ ਅਤੇ ਲੋਕ ਮੇਰੀ ਪ੍ਰਸੰਸਾ ਕਰਦੇ ਹਨ